ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਰਾਮ ਵੈਸ਼ਨੂੰ ਢਾਬੇ ਤੋਂ ਬੋਲ ਰਹੇ ਹੋ ਮੈਂ ਨਾ ਇੱਕ ਆਪਣੇ ਵਾਸਤੇ ਖਾਣਾ ਔਡਰ ਕਰਨਾ ਸੀ ਅਤੇ ਤੁਸੀਂ ਦੱਸ ਸਕਦੇ ਹੋ ਵੀ ਤੁਹਾਡੇ ਮੈਨਿਊ 'ਚ ਸਭ ਤੋਂ ਵਧੀਆ ਸਭ ਤੋਂ ਪਸੰਦ ਵਾਲ਼ੀ ਚੀਜ਼ ਲੋਕਾਂ ਨੂੰ ਪਸੰਦ ਆਵੇ ਤਾਂ ਉਹ ਕਿਹੜੀ ਚੀਜ਼ ਹੈ ਮੈਂ ਨਾ ਥੋੜ੍ਹਾ ਖਾਣਾ ਔਰਡਰ ਕਰਨਾ ਸੀ ਚਾਰ ਬੰਦਿਆਂ ਦਾ ਤੁਸੀਂ ਦੱਸ ਇਕ ਵਾਰ ਦੱਸ ਦਿਉ ਅਤੇ ਕਿਹੜਾ ਕਿਹੜਾ ਵਧੀਆ ਹੈ ਤੁਸੀਂ ਇੱਦਾਂ ਕਰਿਓ ਉਸ ਉਸਦੀਆਂ ਨਾ ਮੈਨੂੰ ਚਾਰ ਪੰਜ ਪਲੇਟਾਂ ਪੰਜ ਪਲੇਟਾਂ ਪੈਕ ਕਰਕੇ ਭੇਜ ਦਿਓ ਜਦ ਤੁਸੀਂ ਮੈਨੂੰ ਦੱਸ ਸਕਦੇ ਵੀ ਮੇਰੇ ਉਹ ਪਿੰਡ ਖਿਜ਼ਰਾਬਾਦ ਤਕੀਆ ਮੁਹੱਲੇ ਕੋਲ ਭੇਜਣਾ ਹੈ ਜਦੋਂ ਵੀ ਤੁਸੀਂ ਕਿਸੇ ਕੋਲ ਆਪਣਾ ਔਡਰ ਭੇਜੋਗੇ ਮੈਂ ਜਦੇ ਤੁਹਾਨੂੰ ਪੇਮੈਂਟ ਕਰ ਦੂੰਗਾ